ਹੈਲੋ ਹਾਂ ਸਤਿ ਸ਼੍ਰੀ ਅਕਾਲ ਸਰ ਹਾਂ ਹਾਂਜੀ ਸਰ ਤੁਸੀਂ ਪੋਸਟ ਆਫਿਸ ਤੋਂ ਬੋਲਦੇ ਪਏ ਹੋ ਨਾ ਹਾਂ ਹਾਂਜੀ ਸਰ ਸਰ ਮੇਰਾ ਨਾ ਐਕਚੁਲੀ ਮੇਰੇ ਬ੍ਰਦਰ ਨੇ ਬਰਥਡੇ ਗਿਫਟ ਸੈਂਡ ਕੀਤਾ ਸੀ ਮੈਨੂੰ ਭੇਜਿਆ ਸੀ ਮੋਹਾਲੀ ਤੋਂ ਹਾਂਜੀ ਸਰ ਅਤੇ ਸਰ ਉਹ ਨਾ ਐਕਚੁਲੀ ਮੇਰੇ ਘਰ ਦਾ ਪੁਰਾਣਾ ਐਡਰੈਸ ਸੀਗਾ ਸਰ ਮੋਡਲ ਟਾਊਨ ਕੇ ਕੇ ਰੋਡ 'ਤੇ ਮੋਡਲ ਟਾਊਨ ਗਲੀ ਨੰਬਰ ਤਿੰਨ ਸ਼੍ਰੀ ਮੁਕਤਸਰ ਸਾਹਿਬ ਦਾ ਐਡਰੈਸ ਸੀਗਾ ਇੱਕ ਵਾਰ ਚੈੱਕ ਕਰ ਲਓ ਹਾਂਜੀ ਸਰ ਸਰ ਮੈਂ ਆਪਣੇ ਗੁਆਂਡੀਆਂ ਨੂੰ ਉੱਥੇ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਹਜੇ ਤੱਕ ਕੋਈ ਵੀ ਕੋਰੀਅਰ ਨਹੀਂ ਆਇਆ ਸਰ ਬਹੁਤ ਕੀਮਤੀ ਹੈ ਮਤਲਬ ਕੀਮਤੀ ਗਿਫਟ ਸੀਗਾ ਅਤੇ ਜੇ ਮਤਲਬ ਮੇਰੇ ਪਾਪਾ ਨੂੰ ਪਤਾ ਚੱਲ ਗਿਆ ਜੇ ਗੁੰਮ ਗਿਆ ਤਾਂ ਮੈਨੂੰ ਅਤੇ ਮੇਰੇ ਬ੍ਰਦਰ ਨੂੰ ਮਤਲਬ ਫਿਰ ਡਾਂਟ ਪੈਣੀ ਆ ਸੋ ਮਾੜਾ ਜਿਹਾ ਦੇਖ ਲਿਓ ਹਾਂਜੀ ਸਰ ਨਿਊ ਐਡਰੈਸ ਨਿਊ ਐਡਰੈਸ ਸਰ ਨੋਟ ਕਰ ਲਓ ਨਿਊ ਐਡਰੈਸ ਹੈਗਾ ਬਠਿੰਡਾ ਰੋਡ ਬਾਈਪਾਸ ਸ਼੍ਰੀ ਮੁਕਤਸਰ ਸਾਹਿਬ ਗਲੀ ਨੰਬਰ ਚਾਰ ਹਾਂਜੀ ਸਰ ਹਾਂਜੀ ਸਰ ਕੋਈ ਗੱਲ ਨਹੀਂ ਸਰ ਪਹਿਲਾਂ ਵੀ ਮੈਂ ਮਤਲਬ ਦੋ ਤਿੰਨ ਵਾਰ ਕਾਲ ਕੀਤੀ ਆ ਹੈ ਨਾ ਕੋਈ ਕਾਲ ਰਸੀਵ ਨਹੀਂ ਹੋਈ ਗੀ ਹੁਣ ਜਾ ਕੇ ਮੇਰੀ ਕਾਲ ਅਟੈਂਡ ਹੋਈ ਹੈ ਹਾਂਜੀ ਸਰ ਕੋਈ ਗੱਲ ਨਹੀਂ ਸਰ ਹਾਂਜੀ ਸਰ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਜੀ